ਹੈਲੋ ਹਾਂਜੀ ਨਮਸਤੇ ਜੀ ਹਾਂਜੀ ਕਿੱਥੋਂ ਆਏ ਤੁਸੀਂ ਹਾਂਜੀ ਹਾਂਜੀ ਮਤਲਬ ਮੈਂ ਕਿਹਨੂੰ ਕਹਿੰਦੇ ਆਰ ਕੇ ਬਹੁਤ ਵਧੀਆ ਬਹੁਤ ਵਧੀਆ ਮੈਮ ਬਹੁਤ ਵਧੀਆ ਖਾਣਾ ਉੱਥੋਂ ਦਾ ਅਸੀਂ ਉੱਥੇ ਮਤਲਬ ਫੰਕਸ਼ਨ ਵਗੈਰਾ ਉੱਥੇ ਕਰਦੇ ਹਾਂ ਅਤੇ ਸਭ ਚੀਜ਼ ਵਧੀਆ ਵਾ ਅਤੇ ਖਾਣਾ ਵੀ ਬਹੁਤ ਵਧੀਆ ਵਾ ਅਤੇ ਹਾਂਜੀ ਕੋਈ ਫੈਮਲੀ ਜਾਓਗੇ ਕਿ ਕਾਹਦਾ ਹਾਂਜੀ ਹਾਂਜੀ ਬਹੁਤ ਖਾਣਾ ਤਾਂ ਬਿਲਕੁਲ ਟੋਪ 'ਤੇ ਆ ਅਤੇ ਹਾਂ ਉੱਥੇ ਪਲੇਟ ਸਿਸਟਮ ਆ ਮੇਰੇ ਹਿਸਾਬ ਨਾਲ ਤਾਂ ਉੱਥੇ ਤਿੰਨ ਸੌ ਦੀ ਪਰ ਥਾਲੀ ਆ ਵਧੀਆ ਫਾਸਟ ਫੂਡ 'ਚ ਬਹੁਤ ਕੁਝ ਆ ਜਾਂਦਾ ਗਾ ਅ ਜਿੱਦਾਂ ਤੁਸੀਂ ਲਗਾ ਲਓ ਟਿੱਕੀ ਵਗੈਗਾ ਹਾ ਨੂਡਲ ਡੋਸਾ ਇਹ ਚੀਜ਼ਾਂ ਹਰ ਇੱਕ ਉੱਥੇ ਹੈਗੀਆਂ ਅਤੇ ਸਵੀਟ ਸਵੀਟ ਵੀ ਮਿਲੇਗਾ ਤੁਹਾਨੂੰ ਮਤਲਬ ਕਿ ਮਿੱਠਾ ਵੀ ਮਿਲੇਗਾ ਖਾਣੇ ਤੋਂ ਬਾਅਦ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੈਗਾ ਅਤੇ ਬਾਕੀ ਬਹੁਤ ਵਧੀਆ ਬਹੁਤ ਵਧੀਆ ਫੈਮਲੀ ਪਾਰਟੀ ਕਰਨੀ ਬਹੁਤ ਵਧੀਆ ਉੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਿਲ ਜਾਂਦਾ ਹਾਂਜੀ ਟਾਈਮ ਇਹਦਾ ਉਹੀ ਸਵੇਰੇ ਨੌ ਤੋਂ ਛੇ ਸੱਤ ਵਜੇ ਤੇ ਤੁਸੀਂ ਕਰ ਸਕਦੇ ਜਾ ਕੇ ਉੱਥੇ ਲਿਖਵਾ ਸਕਦੇ ਹੋ ਅਤੇ ਬਾਕੀ ਜਦੋਂ ਤੁਸੀਂ ਬਰਡੇ ਵਗੈਰਾ ਜੋ ਵੀ ਹੋਏ ਕਿਸੇ ਦਾ ਤਾਂ ਤੁਸੀਂ ਉਹਨਾਂ ਨੂੰ ਲੈ ਕੇ ਆ ਸਕਦੇ ਹੋ ਹਾਂਜੀ ਇੱਕ ਤਾਂ ਓਕੇ ਓਕੇ